ਹੈਲੋ ਹੈਲੋ ਹਾਂਜੀ ਸਨੀ ਬੋਲ ਰਹੇ ਹੋ ਹਾਂਜੀ ਸੰਨੀ ਮੈਂ ਤੁਹਾਨੂੰ ਇਹ ਕਹਿੰਦੀ ਸੀਗੀ ਮਤਲਵ ਕੱਲ ਤੁਸੀਂ ਟਾਈਮ ਨਾਲ ਆਜੋਗੇ ਘਰੇ ਏਥੇ ਕੰਮ ਤੇ ਹਾਂਜੀ ਸਵੇਰੇ ਸਵੇਰੇ ਨਾ ਟਾਈਮ ਨਾਲ ਈ ਆਜਿਓ ਜੇ ਤੁਸੀਂ ਕਿਉਂਕੀ ਨਾ ਮਤਲਵ ਮੈਨ ਮੇਰੀ ਸੁਬਹਾ ਡਿਊਟੀ ਲੱਗ ਗੀ ਆ ਤੇ ਮੈਂ ਜਾਣਾ ਆਪਦੇ ਕੰਮ ਤੇ ਤੇ ਪਿੱਛੋਂ ਬੱਚਿਆਂ ਦਾ ਨਾਸ਼ਤਾ ਵਗੈਰਾ ਤੇ ਤੇਰੇ ਬਈਆ ਦਾ ਨਾਸ਼ਤਾ ਤੇ ਮੰਮੀ ਹੋਰਾਂ ਦਾ ਨਾਸ਼ਤਾ ਸਾਰਾ ਕੁਛ ਤੈਨੂੰ ਹੀ ਕੰਮ ਕਰਨਾ ਪਏਗਾ ਕਿਉਂਕੀ ਮੈਂ ਸਵੇਰੇ ਸਵੇਰੇ ਟਾਈਮ ਨਾਲ ਈ ਚਲੇ ਜਾਣਾ ਹਾਂ ਤੇ ਇੱਕ ਨਾਲੇ ਹਾਂ ਵਿੱਚੋਂ ਦੀ ਥੋੜੀ ਦੇਰ ਵਾਸਤੇ ਜਦੋਂ ਮੈਂ ਆਜੇਗੀ ਨਾ ਥੋੜੀ ਦੇਰ ਵਾਸਤੇ ਉਦੋਂ ਚਲੇ ਜਾਏ ਲੇਕਿਨ ਫਿਰ ਵਾਪਸ ਆਉਣਾ ਪੈਣਾ ਕਿਉਂਕਿ ਤੈਨੂੰ ਪਤਾ ਹੀ ਨਹੀਂ ਸ਼ਾਮ ਨੂੰ ਆਪਣੇ ਘਰੇ ਪਾਰਟੀ ਐ ਹਾਂ ਤੇ ਫਿਰ ਪਾ ਹਾਂ ਹਾਂ ਕੋਈ ਗੱਲ ਹਾਂ ਹਾਂ ਕੋਈ ਗੱਲ ਨਹੀਂ ਬਸ ਇੱਕ ਵਾਰੀ ਨਾਸ਼ਤਾ ਤੇ ਰੋਟੀ ਦਾ ਮਾੜਾ ਮੋਟਾ ਕਰ ਦੀ ਕਿਉਂਕਿ ਫਿਰ ਮੰਮੀ ਤੋਂ ਤਾਂ ਕੰਮ ਹੁੰਦਾ ਨੀ ਤੈਨੂੰ ਪਤਾ ਈ ਆ ਹਾਂ ਸਾਰਾ ਫਿਰ ਸਾਨੂੰ ਦੇਖਣਾ ਪੈਣਾ ਤੇ ਤਾਂ ਕਰਕੇ ਫਿਰ ਤੂੰ ਟਾਈਮ ਨਾਲ ਆਈ ਇਹ ਨਾ ਹੋਵੇ ਵੀ ਤੂੰ ਟਾਈਮ ਤੇ ਆਵੇ ਨਾ ਤੇ ਮੈਨੂੰ ਦਿੱਕਤ ਬੜੀ ਹੋ ਜਾਵੇ ਹਾਂ ਤੂੰ ਟਾਈਮ ਨਾਲ ਆ ਜਾਣਾ ਤੇ ਫਿਰ ਸ਼ਾਮ ਨੂੰ ਪਾਰਟੀ ਸ਼ਾਮ ਨੂੰ ਆਪਾਂ ਇੱਕ ਤਾਂ ਪਤਾ ਹੀ ਹ ਸਨੈਕਸ ਵਗੈਰਾ ਤਾਂ ਵੈਸੇ ਬਾਹਰੋਂ ਆ ਜਾਣਗੇ ਪਰ ਥੋੜੇ ਬਹੁਤੇ ਕੁਝ ਸਫਾਈ ਬਰਤਨ ਇਹ ਵੀ ਚੀਜ਼ਾਂ ਹੋ ਜਾਂਦੀਆਂ ਤੇ ਨਾਲੇ ਫਿਰ ਥੋੜਾ ਬਹੁਤ ਕਈ ਵਾਰੀ ਚਾਹ ਪਾਣੀ ਦਾ ਵੀ ਕਰਨਾ ਪੈ ਜਾਂਦਾ ਹਾਂ ਤੇ ਕਰ ਹਾਂ ਤਾਂ ਹੀ ਤੈਨੂੰ ਕਹਿ ਰਹੀ ਆ ਨਾ ਮੈਨੂੰ ਪਤਾ ਵੀ ਤੂੰ ਆਪਦਾ ਘਰ ਸਮਝ ਕੇ ਕਰਦੀ ਹ ਤਾਂ ਹੀ ਤੈਨੂੰ ਕਹਿ ਰਹੀ ਕਿਸੇ ਤੇ ਤਾਂ ਨਹੀਂ ਵਿਸ਼ਵਾਸ ਕੀਤਾ ਜਾਂਦਾ ਅੱਜ ਕੱਲ ਤੇ ਹੁਣ ਪਹੁੰਚ ਟਾਈਮ ਨਾਲ ਜਾਈ ਤੇ ਨਾਲੇ ਰਾਤ ਨੂੰ ਹੋ ਸਕਦਾ ਦੇਰ ਹੋ ਜੇ ਤੇ ਥੋੜਾ ਜਿਹਾ ਮਤਲਬ ਘਰੇ ਕਹਿ ਕੇ ਆਈ

ਹਾਂ ਤੇਰੇ ਬਈਆ ਛੱਡ ਆਣਗੇ ਰਾਤ ਨੂੰ ਰਾਤ ਨੂੰ ਮਤਲਬ ਚਾਹੇ ਮੈਂ ਵੀ ਨਾਲ ਤੇਰੇ ਚਲਦੀ ਰਹੂੰਗੀ ਕੋਈ ਗੱਲ ਨਹੀਂ ਤੈਨੂੰ ਛੱਡ ਆਵਾਂਗੇ ਪਰ ਘਰੇ ਕਹਿ ਕੇ ਆਣਾ ਇਹ ਗੱਲ ਵੀ ਮੈਨੂੰ ਟਾਈਮ ਲੱਗ ਸਕਦਾ ਵੀ ਇਹ ਨਾ ਹੋਵੇ ਮਤਲਬ ਪਾਰਟੀ ਦਾ ਟਾਈਮ ਹੋਵੇ ਤੇ ਤੂੰ ਕਵੇਂ ਨਹੀਂ ਮੈਂ ਤਾਂ ਹੁਣ ਚੱਲੀ ਆਂ ਤੇ ਫਿਰ ਉਹ ਮੈਨੂੰ ਫਿਰ ਦਿੱਕਤ ਹੋਜੇਗੀ ਹਾਂ ਹਾਂ ਹਾਂ ਨੋ ਵਜੇ ਤੱਕ ਤਾਂ ਹੋਜੇਗੀ ਹਾਂ ਹਾਂ ਨੌ ਵਜੇ ਤੱਕ ਤਾਂ ਹੋ ਜਾਏਗੀ ਉਸ ਤੋਂ ਬਾਅਦ ਆਪਾਂ ਕੰਮ ਨਿਪਟਾ ਕੇ ਫਿਰ ਤੈਨੂੰ ਛੱਡ ਵੀ ਆਵਾਂਗੇ ਘਰ ਤੱਕ ਛੱਡ ਆਵਾਂਗੇ ਟੈਨਸ਼ਨ ਲੈਣ ਦੀ ਲੋੜ ਨੀ ਠੀਕ ਹ ਬਾਕੀ ਆ ਜੀ ਤੇ ਸੁਬਹਾ ਕੋਸ਼ਿਸ਼ ਕਰੀ ਟਾਈਮ ਨਾਲ ਆਈ ਕਿਉਂਕਿ ਹੋ ਸਕਦਾ ਤੈਨੂੰ ਬੱਚਿਆਂ ਨੂੰ ਉਠਾਣਾ ਵੀ ਪਵੇ ਸਕੂਲ ਵਾਸਤੇ ਤਿਆਰ ਵੀ ਕਰਨਾ ਪਵੇ ਪਤਾ ਲੱਗ ਜਾਏਗਾ ਨਾ ਸਕੂਲ ਵਾਸਤੇ ਤਿਆਰ ਹਾਂ ਬਸ ਇਹਨਾਂ ਨੂੰ ਨਾਲੇ ਸਕੂਲ ਵਾਸਤੇ ਤਿਆਰ ਕਰਨਾ ਨਾਲੇ ਉਹਨਾਂ ਦਾ ਲੰਚ ਵਗੈਰਾ ਪੈਕ ਹਾਂ ਉਹ ਪੈਕ ਕਰਕੇ ਤੇ ਉਹਨਾਂ ਦੇ ਬੈਗ ਵਗੈਰਾ ਵਿੱਚ ਰੱਖਦੀ ਉਹਨਾਂ ਦਾ ਬੈਗ ਥੋੜਾ ਬਹੁਤਾ ਵੈਸੇ ਤਾਂ ਮੈਂ ਰੈਡੀ ਕਰ ਜਾਵਾਂਗੀ ਪਰ ਥੋੜਾ ਬਹੁਤਾ ਤਿਆਰ ਚ ਵੀ ਦੇਖ ਲਈ ਵੀ ਉਹਨਾਂ ਨੇ ਪਾ ਲਿਆ ਸਮਾਨ ਸਮੂਨ ਕੁਛ ਰਹਿ ਤਾਂ ਨੀ ਗਿਆ ਹਾਂ ਹਾਂ ਹਾਂ ਹਾਂ ਬੱਸ ਹੁਣ ਟਾਈਮ ਨਾਲ ਆਹ ਵੀ ਜਰੂਰ ਕਿਉਂਕਿ ਮੇਰੇ ਤੋਂ ਸਵੇਰੇ ਸਵੇਰੇ ਫੋਨ ਨੀ ਤੈਨੂੰ ਦੁਬਾਰਾ ਦੁਬਾਰਾ ਠੀਕ ਹ ਹਾਂ ਠੀਕ ਹ ਠੀਕ ਐ ਠੀਕ